ਜਿਸ ਪੰਜਾਬੀ ਇੱਕ ਪੰਜਾਬੀ ਨਿਊਜ਼ ਚੈਨਲ ਹੈ ਜੋ ਸਮਾਜਿਕ ਮਾਮਲਿਆਂ ਮੌਜੂਦਾ ਹਾਲਾਤ ਅਤੇ ਆਰਥਿਕ ਵਿਕਾਸਾਂ ਬਾਰੇ ਕਵਰੇਜ ਕਰਦਾ ਹੈ ਤੁਸੀਂ ਜਿਸ ਜਿਸ ਪੰਜਾਬੀ ਨੂੰ ਜੀਓ ਟੀ ਵੀ 'ਤੇ ਦੇਖ ਸਕਦੇ ਹੋ ਪੰਜਾਬ ਜਿਸ ਪੰਜਾਬ ਇੱਕ ਪੰਜਾਬ ਨਿਊਜ਼ ਚੈਨਲ ਹੈ ਜੋ ਸਮਾਜਿਕ ਮਾਮਲਿਆਂ ਮੌਜੂਦਾ ਹਾਲਾਤ ਅਤੇ ਆਰਥਿਕ ਵਿਕਾਸ ਨੂੰ ਬਾਰੇ ਕਵਰੇਜ ਕਰਦਾ ਹੈ ਤੁਸੀਂ ਯੂਸਫ ਪੰਜਾਬੀ ਨੂੰ ਜੀਓ ਟੀ ਵੀ 'ਤੇ ਦੇਖ ਸਕਦੇ ਹੋ ਜੋ ਸਬ ਪੰਜਾਬੀ ਦੇ ਹੋਸਟ ਕੁਛ ਨਾਵੀਤਮ ਅਪਡੇਟ ਮੌਜੂਦਾ ਹਾਲਾਤ ਵਿੱਚ ਆਰਥਿਕ ਰਾਜਨੀਤਿਕ ਅਤੇ ਸਮਾਜਿਕ ਮਾਮਲਿਆਂ ਨਾਲ ਸੰਬੰਧਿਤ ਵਿਕਾਸਾਂ ਦੀ ਜਾਣਕਾਰੀ ਪੇਸ਼ ਕਰਦੇ ਹਨ